ਹੈਲੋ ਸਸਰੀਕਾਲ ਜੀ ਮੈਂ ਅਰੁਣਾ ਬੋਲ ਰਹੀ ਆਂ ਮੈਨੂੰ ਸਕੈਚ ਪੈੱਨਾਂ ਦਾ ਬੜਾ ਸ਼ੌਂਕ ਆ ਕਲਰਾਂ ਦਾ ਬਹੁਤ ਜਿਆਦਾ ਮੈਂ ਘਰ ਵਿੱਚ ਸਕੈਚ ਪੈੱਨ ਵਰਤਦੀ ਆ ਮੈਂ ਕਲਰ ਬੜੇ ਬਣਾਉਨੀ ਆ ਚੀਜ਼ਾਂ ਬਣਾਉਦੀ ਆ ਜਿੱਦਾ ਭਗਵਾਨ ਦੀਆਂ ਤਸਵੀਰਾਂ ਜੈ ਭੋਲੇਨਾਥ ਦੀ ਮਾਂ ਪਾਰਵਤੀ ਗਨੇਸ਼ ਮਹਾਰਾਜ ਦੀ ਇਹਨਾਂ ਦੀ ਮੈਂ ਕਲਰ ਕਰਦੀ ਆਂ ਤੇ ਇਹਨਾਂ ਦੀਆਂ ਜਿੱਦਾਂ ਦੀਆਂ ਪਿਛਾਕਾਂ ਹੁੰਦੀਆਂ ਮੈਂ ਉਸ ਉਸੇ ਕਲਰ ਵਿੱਚ ਜਿਹੜਾ ਮੇਰੇ ਮਨ ਨੂੰ ਚੰਗਾ ਲੱਗਦਾ ਮੈਂ ਉਹ ਕਲਰ ਵਿੱਚ ਭਰ ਦਿੰਦੀ ਆ ਤੇ ਉਹ ਬਾਕੀ ਐ ਵਾ ਵੀ ਕਿੰਨਾ ਨੇ ਮੈਨੂੰ ਬੜਾ ਸ਼ੌਂਕ ਆ ਮੇਰੇ ਬੱਚੇ ਆ ਉਹ ਵੀ ਬਹੁਤ ਪੇਂਟਿੰਗ ਦਾ ਕੰਮ ਕਰਦੇ ਆ ਬਣਾਉਂਦੇ ਆ ਘਰ ਦੇ ਵਿੱਚ ਕਲਰ ਬਹੁਤ ਜਿਆਦਾ ਬੱਚਿਆਂ ਨੂੰ ਵੀ ਸ਼ੌਂਕ ਆ ਤੇ ਮੈਨੂੰ ਵੀ ਬਹੁਤ ਜਿਆਦਾ ਸ਼ੌਂਕ ਆ ਸਵੇਰੇ ਉੱਠ ਕੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਸ਼੍ਰੀ ਰਾਮ ਜੀ ਸੀਤਾ ਤੇ ਭੋਲੇਨਾਥ ਦੀ ਮਾਂ ਪਾਰਵਤੀ ਦੀਆਂ ਉਹ ਮੈਂ ਬਣਾਈ ਦੀਆਂ ਫੋਟੋਆਂ ਮੈਂ ਡਰਾਇੰਗ ਰੂਮ ਲਾਈ ਵੀਆਂ ਸਵੇਰੇ ਮੈਂ ਉੱਠਦੀ ਆਂ ਦਰਸ਼ਨ ਕਰਨੀ ਮੇਰੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਤਸੱਲੀ ਹੁੰਦੀ ਐ ਵੀ ਐਹ ਮੈਂ ਬਣਾਇਆ ਤੇ ਬਹੁਤ ਜਿਆਦਾ ਸੋਹਣੇ ਲੱਗਣੇ ਆ ਬਈ ਜਿੱਦਾਂ ਪਿਸ਼ਾਕਾ ਹੀ ਪਾਈ ਦੀਆਂ ਇਹਨਾਂ ਨੇ ਇਸ ਕਲਰ ਦੇ ਵਿੱਚ ਬਹੁਤ ਜਿਆਦਾ ਸੁੰਦਰ ਲੱਗ ਰਹੇ ਆ ਤੇ ਬਾਕੀ ਐਹ ਵਾ ਮੈਂ ਮਿੱਟੀ ਦਾ ਵੀ ਬਣਾਉਦੀ ਆ ਜਿੱਦਾਂ ਘੜੇ ਹੋਰ ਕਿੰਨਾਂ ਨੇ ਗਮਲੇ ਵਗੈਰਾ ਇਹਨਾਂ ਤੇ ਡਿਜ਼ਾਇਨ ਪਾ ਪਾ ਕੇ ਤੇ ਮਿੱਟੀ ਦੇ ਨਾਲ ਹੀ ਬਹੁਤ ਸੋਹਣੇ ਬਣਾਉਦੇ ਆ ਵਿੱਚ ਕਿੰਨਾਂ ਨੇ ਮੈਂ ਰੱਖਦੀ ਆਂ ਉਹਨਾਂ ਦਾ ਐ ਵਾ ਵੀ ਜਿਆਦਾ ਸੋਹਣੇ ਲੱਗਣ